ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਟਰਾਂਸਪੋਰਟ ਏਜੰਸੀ ਵਿੱਚ ਇੱਕ ਸ਼ਿਕਾਇਤ ਦਰਜ ਕਰਨੀ ਹੈ ਮੈਂ ਅੱਜ ਹੀ ਤੁਹਾਡੀ ਇੱਕ ਏਜੰਸੀ ਦੀ ਕੈਬ ਬੁੱਕ ਕੀਤੀ ਸੀ ਅਤੇ ਕਿਉਂਕਿ ਮੈਂ ਇੰਟਰਵਿਊ ਲਈ ਜਾਣਾ ਸੀਗਾ ਅਤੇ ਇੰਟਰਵਿਊ ਮੇਰੀ ਕਾਫੀ ਦੂਰ ਸੀ ਅਤੇ ਜਦੋਂ ਕੈਬ ਵਿੱਚ ਮੈਂ ਬੈਠੀ ਤਾਂ ਦੇਖਿਆ ਕਿ ਆਸੇ ਪਾਸੇ ਬਹੁਤ ਹੀ ਗੰਦਗੀ ਸੀ ਸੀਟਾਂ ਦੇ ਥੱਲੇ ਸੀਟ ਦੇ ਉੱਪਰ ਅਤੇ ਮੈਨੂੰ ਇੰਟਰਵਿਊ ਲਈ ਬਹੁਤ ਜਲਦੀ ਸੀ ਤਾਂ ਮੈਨੂੰ ਉਸ ਵਿੱਚ ਹੀ ਬੈਠਣਾ ਪਿਆ ਖਾਲੀ ਬੋਤਲਾਂ ਸੁੱਟੀਆਂ ਹੋਈਆਂ ਸਨ ਪਾਣੀ ਦੀਆਂ ਅਤੇ ਸੀਟਾਂ ਉੱਤੇ ਨੈਪਕਿਨ ਵਗੈਰਾ ਸੁੱਟੇ ਹੋਏ ਸਨ ਉੱਦਾਂ ਹੀ ਅਤੇ ਅਖਬਾਰਾਂ ਸੁੱਟੀਆਂ ਹੋਈਆਂ ਸਨ ਖਰਾਬ ਕਰਕੇ ਅਤੇ ਸੀਟਾਂ ਦੀ ਵੀ ਹਾਲਤ ਬਹੁਤ ਹੀ ਖਰਾਬ ਸੀ ਅਤੇ ਉੱਤੋਂ ਬਾਹਰ ਇੰਨੀ ਜ਼ਿਆਦਾ ਗਰਮੀ ਸੀ ਤਾਂ ਜਦੋਂ ਮੈਂ ਡਰਾਈਵਰ ਨੂੰ ਏ ਸੀ ਔਨ ਕਰਨ ਲਈ ਕਿਹਾ ਤਾਂ ਉਸਨੇ ਦੱਸਿਆ ਕਿ ਏ ਸੀ ਖਰਾਬ ਹੈ ਕਾਫੀ ਦਿਨਾਂ ਤੋਂ ਬੰਦ ਹੈ ਤਾਂ ਮੇਰੀ ਹਾਲਤ ਬਹੁਤ ਹੀ ਖਰਾਬ ਹੋ ਗਈ ਪਰ ਮੇਰੇ ਕੋਲ ਹੋਰ ਕੋਈ ਆਪਸ਼ਨ ਵੀ ਨਹੀਂ ਸੀ ਮੈਨੂੰ ਉਹੀ ਕੈਬ 'ਤੇ ਜਾਣਾ ਪਿਆ ਔਰ ਉਹਦੀ ਹਾਲਤ ਦੇਖ ਕੇ ਮੈਨੂੰ ਬਹੁਤ ਹੀ ਜ਼ਿਆਦਾ ਨਿਰਾਸ਼ਾ ਹੋਈ ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਇਹਨਾਂ ਚੀਜ਼ਾਂ ਬਾਰੇ ਧਿਆਨ ਰੱਖੋ ਜੋ ਵੀ ਤੁਸੀਂ ਆਪਣੇ ਕੈਬ ਲਈ ਜਿਨ੍ਹਾਂ ਨੂੰ ਡਰਾਈਵਰ ਰੱਖਿਆ ਹੈ ਉਹਨਾਂ ਨੂੰ ਇਹ ਗੁਜ਼ਾਰਿਸ਼ ਕਰੋ ਕਿ ਉਹ ਕੈਬ ਸਾਫ ਸੁਥਰੀ ਰੱਖਣ ਸਫਾਈ ਰੱਖਣ ਔਰ ਏ ਸੀ ਦੀ ਸਰਵਿਸ ਕਰਵਾਉਣ ਜਿਹਦੇ ਕਰਕੇ ਤੁਹਾਡੇ ਕਿਸੇ ਵੀ ਕਸਟਮਰ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਅਤੇ ਦੂਸਰਾ ਮਾਸਕ ਲਗਾ ਕੇ ਰੱਖਣ ਜਿਹਦੇ ਕਰਕੇ ਉਹਨਾਂ ਦੀ ਵੀ ਸੇਫਟੀ ਹੋਵੇ ਅਤੇ ਸਾਡੀ ਵੀ ਸੇਫਟੀ ਹੋਵੇ ਧੰਨਵਾਦ